ਸਾਡੇ ਰਾਜ ਦੀ ਜਿਹੜੀ ਰਾਜ ਭਾਸ਼ਾ ਪੰਜਾਬੀ ਭਾਸ਼ਾ ਹੈ ਪੰਜਾਬੀ ਭਾਸ਼ਾ ਸਾਡੇ ਸਮੁੱਚੇ ਸੱਭਿਆਚਾਰ ਸਾਡੇ ਕਹਿੰਦੇ ਨੇ ਪੰਜਾਬੀਆਂ ਦੀ ਜੋ ਪੰਜਾਬੀਅਤ ਭਾਵਨਾ ਉਹਨੂੰ ਪੇਸ਼ ਕਰਦੀ ਹੈ ਇਸੇ ਨਹੀਂ ਜੋ ਵੀ ਅੱਜ ਪੰਜਾਬੀ ਵਿੱਚ ਜਿੰਨਾ ਬੋਲ ਕੇ ਅਸੀਂ ਸਕੂਨ ਮਹਿਸੂਸ ਕਰਦੇ ਹਾਂ ਉੰਨਾ ਕਿਸੇ ਹੋਰ ਭਾਸ਼ਾ ਵਿੱਚ ਬੋਲ ਕੇ ਸਕੂਨ ਮਹਿਸੂਸ ਨਹੀਂ ਕਰਦੇ ਇਸ ਤੋਂ ਇਲਾਵਾ ਹਿੰਦੀ ਅਤੇ ਅੰਗਰੇਜ਼ੀ ਸੰਪਰਕ ਭਾਸ਼ਾਵਾਂ ਜ਼ਰੂਰ ਹਨ ਲੇਕਿਨ ਜੋ ਪੰਜਾਬੀ ਭਾਸ਼ਾ ਸਾਡੀ ਪੰਜਾਬੀਆਂ ਦੀ ਵਿਰਾਸਤ ਪੰਜਾਬੀਆਂ ਦਾ ਸੱਭਿਆਚਾਰ ਨੂੰ ਪੇਸ਼ ਕਰਦੀ ਹੈ ਪੰਜਾਬੀ ਕਿਵੇਂ ਪੈਦਾ ਹੋਈ ਪੰਜ ਪਲੱਸ ਆਬ ਮਤਲਬ ਕਿ ਪੰਜ ਦਰਿਆਵਾਂ ਦੀ ਧਰਤੀ ਪੰਜਾਬ ਅਤੇ ਇਸੇ ਹੀ ਪੰਜ ਦਰਿਆਵਾਂ ਦੀ ਧਰਤੀ ਜਿਹੜੀ ਭਾਸ਼ਾ ਹੈ ਉਹ ਪੰਜਾਬੀ ਹੈ ਪੰਜ ਦਰਿਆ ਜੋ ਸਾਡੇ ਪੰਜਾਬ ਦੇ ਸ ਸੱਭਿਆਚਾਰ ਵਿਰਾਸਤ ਨੂੰ ਜਿਹੜੀ ਭੂਗੋਲਿਕ ਸਥਿੱਤੀ ਨੂੰ ਪੇਸ਼ ਕਰਦੇ ਹਨ ਅਤੇ ਉਸ ਉਸੇ ਹੀ ਰਾਜ ਦੀ ਭਾਸ਼ਾ ਹੈ ਪੰਜਾਬੀ ਇਸ ਦੀ ਜਿਹੜੀ ਲਿਪੀ ਹੈ ਗੁਰਮੁਖੀ ਹੈ ਉਹ ਗੁਰਮੁਖੀ ਲਿਪੀ ਗੁਰੂਆਂ ਦੀ ਦਿੱਤੀ ਹੋਈ ਲਿਪੀ ਹੈ ਗੁਰਮੁਖੀ ਗੁਰੂਆਂ ਦੀ ਦੀ ਦਿੱਤੀ ਹੋਈ ਲਿਪੀ ਹੈ ਉਸ ਲਿਪੀ ਦਾ ਲਗਾਤਾਰ ਜਿਹੜਾ ਵਤ ਪਰਿਵਰਤਨ ਆਉਂਦੇ ਰਹੇ ਉਸ ਲਿਪੀ ਵਿੱਚ ਜਿਹੜੀ ਸਾਡਾ ਸੱਭਿਆਚਾਰ ਦੀ ਪਹਿਚਾਣ ਸਾਡੀ ਵਿਰਾਸਤ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਰਚਨਾ ਹੈ ਉਹ ਪੰਜਾਬੀ ਭਾਸ਼ਾ ਵਿੱਚ ਜਿਹੜੀ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਰਚਨਾ ਹੈ ਸਾਡੇ ਸਮੁੱਚੇ ਸਮੁੱਚੀ ਸੱਭਿਆਚਾਰ ਦਾ ਇੱਕ ਪਹਿਚਾਣ ਚਿੰਨ੍ਹ ਹੈ ਜੋ ਬਹੁਤ ਹੀ ਢੇਰਾਂ ਸਦੀਆਂ ਪੁਰਾਣਾ ਹੈ ਉਸ ਨੂੰ ਸਾਡੀ ਪੰਜਾਬੀ ਭਾਸ਼ਾ ਵਿੱਚ ਪੇਸ਼ ਕੀਤਾ ਗਿਆ ਇਸੇ ਤਰ੍ਹਾਂ ਹੀ ਇਹ ਇਹ ਅਜਿਹੀਆਂ ਮਹਾਨ ਘਟਨਾਵਾਂ ਜਾਂ ਮਹਾਨ ਰਚਨਾਵਾਂ ਸਾਡੇ ਜੋ ਪੰਜਾਬੀ ਸੱਭਿਆਚਾਰ ਨੂੰ ਹੈ ਪੰਜਾਬੀ ਸੱਭਿਆਚਾਰ ਪੰਜਾਬੀ ਭਾਸ਼ਾ ਵਿੱਚ ਬਿਆਨ ਕਰਦੀਆਂ ਹਨ ਧੰਨਵਾਦ